ਮੈਂ ਆਪਣੇ ਬਾਰੇ ਗੱਲ ਕਰਾਂ ਤਾਂ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ ਮੈਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਣਾ ਪਸੰਦ ਕਰਦੀ ਹਾਂ ਜਿਹਨਾਂ ਨੂੰ ਕਿ ਸਾਰੇ ਰਿਸ਼ਤੇਦਾਰ ਜ ਜਿਹੜਾ ਵੀ ਕੋਈ ਖਾਂਦਾ ਬਹੁਤ ਪਿਆਰ ਦਿੰਦਾ ਮੈਂ ਆਪਣੇ ਤਜ਼ਰਬੇ ਦੀ ਗੱਲ ਕਰਾਂ ਤਾਂ ਸ ਅੱਜ ਤੋਂ ਚਾਰ ਸਾਲ ਪਹਿਲਾਂ ਮੈਨੂੰ ਮੇਰੇ ਪਾਪਾ ਨੇ ਖਾਣਾ ਬਣਾਉਣਾ ਸਿਖਾਇਆ ਸੀ ਜਿਸ ਨੂੰ ਮੈਂ ਕਿ ਬਹੁਤ ਦਿਲਚਸਪੀ ਨਾਲ਼ ਸਿੱਖਿਆ ਕ ਸਭ ਫਸਟਲੀ ਮੈਂ ਸਭ ਤੋਂ ਪਹਿਲਾਂ ਨਮਕੀਨ ਚੌਲ ਬਣਾਏ ਸੀ ਜਿਹੜੇ ਕਿ ਮੇਰੇ ਪਾਪਾ ਨੇ ਮੈਨੂੰ ਬਣਾਉਣੇ ਸਿਖਾਏ ਸੀ ਜਿਹਦੇ ਵਿੱਚ ਕਿ ਮੈਂ ਸਭ ਤੋਂ ਪਹਿਲਾਂ ਚੌਲ ਭਿਓਂ ਕੇ ਅਤੇ ਪਿਆਜ਼ ਕੱਟ ਕੇ ਸਬਜ਼ੀਆਂ ਵਗੈਰਾ ਕੱਟ ਕੇ ਉਹਨਾਂ ਦਾ ਤੜਕਾ ਲਗਾਇਆ ਅਤੇ ਉਹਨਾਂ ਨੂੰ ਵਿਸਲ ਮਰਵਾ ਕੇ ਕਿ ਚੌਲ ਬਣਾਏ ਉਹ ਚੌਲ ਬਹੁਤ ਹੀ ਜ਼ਿਆਦਾ ਟੇਸਟੀ ਸੀ ਉਹ ਉਸ ਟਾਇਮ ਮੈਨੂੰ ਕੁਕਿੰਗ ਸਿਰਫ਼ ਇੱਕ ਮਜ਼ਬੂਰੀ 'ਚ ਕਰਨੀ ਪਈ ਕਿਉਂਕਿ ਮੇਰੇ ਰਿਸ਼ਤੇਦਾਰ ਘਰੇ ਆਏ ਸੀ ਜਦ ਵੀ ਮੇਰੇ ਰਿਸ਼ਤੇਦਾਰ ਉਹ ਆਉਂਦੇ ਹੈ ਨਾ ਤਾਂ ਉਹ ਹਰ ਵਾਰ ਇਹ ਗੱਲ ਕਹਿੰਦੇ ਕਿ ਉਸ ਵਾਰ ਤੂੰ ਨਮਕੀਨ ਚੌਲ ਬਹੁਤ ਸਵਾਦ ਬਣਾਏ ਸੀ ਅਤੇ ਇਸ ਵਾਰੀ ਵੀ ਸਾਨੂੰ ਬਣਾ ਬਣਾ ਕੇ ਖਵਾਓ ਤਾਂ ਓਸ ਫ਼ਸਟ ਟਾਇਮ ਜਦ ਮੈਂ ਕੁਕਿੰਗ ਕੀਤੀ ਤਾਂ ਉਦੋਂ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਕੁਕਿੰਗ ਕਰਨ 'ਚ ਵੀ ਕਿਉਂਕਿ ਮੇਰੀ ਦਿਲਚਸਪੀ ਸੀ ਅਤੇ ਮੇਰੇ ਬਹੁਤ ਸਾਰੇ ਰਿਸ਼ਤੇਦਾਰਾਂ ਨੇ ਪਸੰਦ ਵੀ ਕੀਤੇ ਅਤੇ ਜੇ ਅੱਜ ਦੀ ਗੱਲ ਕਰਾਂ ਤਾਂ ਅੱਜ ਮੈਂ ਅਲੱਗ ਅਲੱਗ ਤਰ੍ਹਾਂ ਦੀਆਂ ਡਿਸ਼ਜ਼ ਬਣਾਉਨੀ ਹਾਂ ਜਿਹਨਾਂ ਨੂੰ ਕਿ ਮੇਰੇ ਖਾਣ ਵਾਲੇ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅਤੇ ਮੈਂ ਸ ਆਪਣੇ ਪਰਿਵਾਰ ਨੂੰ ਅਲੱਗ ਅਲੱਗ ਤਰ੍ਹਾਂ ਦੀਆਂ ਡਿਸ਼ਜ਼ ਬਣਾ ਕੇ ਬਣਾ ਕੇ ਖਵਾਉਨੀ ਹਾਂ ਜਿਹੜੇ ਜਿਹਦੇ ਵਿੱਚ ਕਿ ਮੇਰੇ ਮੰਮੀ ਪਾਪਾ ਖਾਸ ਤੌਰ ਤੋਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਨੇ ਕਿ ਮੇਰੇ ਹੱਥ ਦੀ ਬਣਾਈ ਰੋਟੀ ਨੂੰ ਸੋ ਮੈਂ ਮੈਂ ਜੇਕਰ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੀ ਗੱਲ ਕਰਾਂ ਤਾਂ ਮੈਂ ਮੈਂ ਬਹੁਤ ਕੁਝ ਸਿੱਖਿਆ ਜੇ ਕਹਿ ਸਕਾਂ ਤਾਂ ਯੂਟਿਊਬ ਚੈਨਲ ਤੋਂ ਜਾਂ ਅਲੱਗ ਅਲੱਗ ਲੋਕਾਂ ਤੋਂ ਮੈਨੂੰ ਖਾਣੇ ਦਾ ਬਹਤੁ ਸ਼ੌਂਕ ਹੈ ਮੈਂ ਇਹ ਚੀਜ਼ਾਂ ਅਲੱਗ ਤੌਰ 'ਤੇ ਸਿੱਖਦੀ ਦੀ ਹੀ ਰਹਿੰਨੀ ਹਾਂ ਪਰ ਅੱਜ ਮੈਂ ਜੇਕਰ ਤਜ਼ਰਬੇ ਨੂੰ ਲੈ ਕੇ ਗੱਲ ਕਰਾਂ ਤਾਂ ਮੈਂ ਆਪਣਾ ਇੱਕ ਯੂਟਿਊਬ 'ਤੇ ਇੰਸਟਾ 'ਤੇ ਪੇਜ਼ ਹੈ ਮੇਰਾ ਮੈਂ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਫੌਲੋ ਵੀ ਕਰਦੀ ਹਾਂ ਅਤੇ ਮੈਂ ਆਪਣੀਆਂ ਪੋਸਟਾਂ ਨੂੰ ਸੈਂਡ ਵੀ ਕਰਦੀ ਹਾਂ ਜਿਹਨਾਂ ਨੂੰ ਕਿ ਲੋਕ ਦੇਖਦੇ ਅਤੇ ਬਹੁਤ ਸਾਰਾ ਪਿਆਰ ਦਿੰਦੇ ਨੇ ਅਤੇ ਅੱਜ ਜੇਕਰ ਮੈਂ ਗੱਲ ਕਰਾਂ ਤਾਂ ਮੈਂ ਅਲੱਗ ਅਲੱਗ ਤਰ੍ਹਾਂ ਦੇ ਪਕਵਾਨਾਂ ਦੇ ਨਾਲ਼ ਆਚਾਰ ਵੀ ਬਣਾਉਣੇ ਬਹੁਤ ਜਾਣਦੀ ਹਾਂ